ਹੈਲੋ ਹਾਂਜੀ ਹਾਂਜੀ ਹੋਰ ਵੀਰ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਹਾਂਜੀ ਵੀਰ ਜੀ ਬਹੁਤ ਵਧੀਆ ਸੀ ਹਰੀ ਕ੍ਰਾਂਤੀ ਜਦੋਂ ਆਈ ਸੀ

ਹਾਂਜੀ ਹਾਂਜੀ ਉਹਨਾਂ ਨੇ ਤਾਂ ਬਹੁਤ ਵਧੀਆ ਕੰਮ ਕੀਤਾ ਸੀ ਹਾਂਜੀ ਹਾਂਜੀ ਉਹਨਾਂ ਨੇ ਵੇਖ ਲਓ ਨਹਿਰਾਂ ਕਢਵਾਈਆਂ ਖੇਤਾਂ ਵਿੱਚ ਕਾਫੀ ਉਹ ਬਿਜਾਈ ਕਰਾਈ ਫਿਰ ਉਹਨਾਂ ਬਹੁਤ ਵਧੀਆ ਕੰਮ ਕੀਤੇ ਜਿਵੇਂ ਬਿਜਲੀ ਲੈ ਕੇ ਆਏ ਫਿਰ ਆਪਾਂ ਡੂੰਘੇ ਬੋਰ ਕਰਾਏ ਹਾਂਜੀ ਹਾਂਜੀ ਹਾਂਜੀ ਬਸ ਇ ਇਹੀ ਤਾਂ ਗੱਲ ਹੈ ਇਹੀ ਹਾਂ ਇਹੀ ਤਾਂ ਗੱਲ ਹੈ ਵੀਰ ਜੀ ਇਸ ਕਰਕੇ ਤਾਂ ਆਪਾਂ ਆਪਾਂ ਇਸੇ ਕਰਕੇ ਤਾਂ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਾਂ ਹਾਂ ਹਾਂ ਵੀਰ ਜੀ ਇਹ ਤਾਂ ਗੱਲ ਬਿਲਕੁਲ ਤੇਰੀ ਸਹੀ ਆ ਵੀ ਅੱਜ ਕੱਲ੍ਹ ਖਰਚਾ ਬਹੁਤ ਜ਼ਿਆਦਾ ਅਤੇ ਆਮਦਨ ਬਹੁਤ ਘੱਟ ਆ ਹਾਂਜੀ ਹਾਂਜੀ ਵੀਰ ਜੀ ਇਸੇ ਕਰਕੇ ਕਹਿੰਦੇ ਆਪਾਂ ਵੀ ਹਰੀ ਕ੍ਰਾਂਤੀ ਰਹਿੰਦੀ ਅਤੇ ਜਦੋਂ ਬਹੁਤ ਵਧੀਆ ਸੀ ਉਸ ਟਾਈਮ 'ਤੇ ਜਿਹੜੀ ਸੀ ਚੀਜ਼ ਪਰ ਜਿਹੜੀਆਂ ਹੁਣ ਦੀਆਂ ਸਰਕਾਰਾਂ ਇਹਨਾਂ ਤਾਂ ਇਹਨਾਂ ਤਾਂ ਹੁਣ ਦੀਆਂ ਸਰਕਾਰਾਂ ਨੇ ਆਪਣੇ ਵਾਸਤੇ ਬਹੁਤ ਮੁਸ਼ਕਿਲ ਕਰਤਾ ਜੋ ਵੀ ਕੰਮ ਕੀਤੇ ਆ ਹਾਂਜੀ ਇਸ ਲਈ ਹੁਣ ਜੇ ਆਪਾਂ ਕੋਈ ਫਸਲ ਮੰਡੀ ਵਿੱਚ ਲੈ ਕੇ ਜਾਂਦੇ ਹਾਂ ਉਹਦਾ ਆਪਾਂ ਨੂੰ ਦਾਮ ਪੂਰਾ ਨਹੀਂ ਮਿਲਦਾ

ਹਾਂਜੀ ਹਾਂਜੀ ਆਹੋ ਹੁਣ ਕੋਈ ਵੀ ਅੱਜ ਕਣਕ ਲਾ ਲਓ ਜਾਂ ਝੋਨਾ ਲਾ ਲਓ ਜਿੰਨਾਂ ਚਿਰ ਆਪਾਂ ਪੰਜ ਛੇ ਸਪਰੇਹਾਂ ਨਹੀਂ ਕਰਦੇ ਉੱਨਾਂ ਚਿਰ ਫਸਲ ਵੀ ਨਹੀਂ ਹੁੰਦੀ

ਆਹ ਅਤੇ ਜੇ ਆਪਾਂ ਸਪਰੇਹਾਂ ਨਾ ਕਰਾਂਗੇ ਆਪਾਂ ਨੂੰ ਫਸਲ ਨਹੀਂ ਹੋਵੇਗੀ ਫਿਰ ਆਪਾਂ ਨੂੰ ਆਪਣੇ ਆਪ 'ਤੇ ਲੱਗਾ ਖਰਚ ਨਹੀਂ ਮਿਲ ਸਕਦਾ ਇਹ ਸਕੀ ਹਾਂ ਮੈਂ ਤਾਂ ਕਹਿੰਦਾ ਫਿਰ ਉਹੀ ਕ੍ਰਾਂਤੀ ਆ ਜੇ ਅਤੇ ਆਪਣਾ ਪੰਜਾਬ ਜਿਹੜਾ ਬੜਾ ਖੁਸ਼ਹਾਲ ਹੋ ਜੇ ਅਤੇ ਆਪਾਂ ਨੂੰ ਹਾਂਜੀ ਹਾਂਜੀ ਕੁਝ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਚਲੋ ਠੀਕ ਹੈ ਚੰਗਾ ਵੀਰ ਜੀ ਓਕੇ ਜੀ